ਸਤਿ ਸ਼੍ਰੀ ਅਕਾਲ ਜੀ ਮੇਰਾ ਨਾਂ ਤੇਜਪਾਲਜੀਤ ਸਿੰਘ ਆ ਅਤੇ ਸਾਡੇ ਭਾਰਤ ਵਿੱਚ ਜਿ ਜਿੰਨੀਆਂ ਵੀ ਖੇਡਾਂ ਖੇਡੀਆਂ ਜਾਂਦੀਆਂ ਹਨ ਉਹ ਬਹੁਤ ਹੀ ਵਧੀਆ ਹਨ ਅਤੇ ਸਟਰੈੱਸ ਰਹਿਤ ਹੁੰਦੀਆਂ ਹਨ ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਸਾਡੇ ਹੁਣ ਖੇਡਾਂ ਨੇ ਖੇਡਾਂ ਦੀ ਜਗ੍ਹਾ ਮੋਬਾਇਲਾਂ ਨੇ ਲੈ ਲਈ ਹੈ ਲੋਕ ਖੇਡਣ ਦੀ ਥਾਂ ਮੋਬਾਈਲਾਂ ਉੱਤੇ ਮੋਬਾਈਲਾਂ ਦਾ ਇਸਤੇਮਾਲ ਕਰਦੇ ਆ ਮੋਬਾਇਲਾਂ ਉੱਤੇ ਗੇਮਾਂ ਖੇਡਣ ਦਾ ਵੱਧ ਇਸਤੇਮਾਲ ਕਰ ਰਹੇ ਹਨ ਜੋ ਕਿ ਬਹੁਤ ਬੁਰਾ ਹੈ ਇਸ ਨਾਲ ਸਾਡਾ ਮਨ ਸਟਰੈਸ ਰਹਿੰਦਾ ਹੈ ਬੱਚੇ ਡਿਪਰੈਸ਼ਨ 'ਚ ਚੱਲ ਜਾਂਦੇ ਸਾਡੀ ਨੌਜਵਾਨ ਪੀੜੀ ਜਿਸ ਕਰਕੇ ਬਹੁਤ ਖਰਾਬ ਹੋ ਹੋ ਰਹੀ ਹੈ ਅਤੇ ਸਾਡੀਆਂ ਲੋਕ ਖੇਡਾਂ ਵੱਲ ਸਾਨੂੰ ਵੱਧ ਧਿਆਨ ਦੇਣਾ ਚਾਹੀਦਾ ਅਤੇ ਵੱਧ ਚੜ੍ਹ ਕੇ ਇਹਨਾਂ ਵਿੱਚ ਹਿੱਸਾ ਲੈਣਾ ਚਾਹੀਦਾ ਹੈ ਕਿਉਂਕਿ ਇਹ ਸਟਰੈੱਸ ਰਹਿਤ ਹੁੰਦੀਆਂ ਹਨ ਇਹਨਾਂ ਨਾਲ ਬੱਚੇ ਦੀ ਮਾਨਸਿਕ ਅਤੇ ਸਰੀਰਕ ਵਿਕਾਸ ਹੁੰਦਾ ਹੈ ਬੱਚੇ ਜਾਂ ਜਵਾਨ ਜੋ ਵੀ ਲੋਕ ਖੇਡਾਂ ਖੇਡਦਾ ਹੈ ਹਰ ਤਰ੍ਹਾਂ ਦੀ ਖੇਡ ਖੇਡਦਾ ਹੈ ਉਸ ਨਾਲ ਉਸ ਨੂੰ ਸਰੀਰਿਕ ਤੰਦਰੁਸਤੀ ਮਿਲਦੀ ਹੈ ਜੋ ਕਿ ਬਹੁਤ ਅੱਜ ਕੱਲ੍ਹ ਦੇ ਹਰ ਇੱਕ ਸ਼ਖਸ ਲਈ ਬਹੁਤ ਜ਼ਰੂਰੀ ਹੈ ਅਤੇ ਖੇਡਾਂ ਬਹੁਤ ਹੀ ਮਹੱਤਵਪੂਰਨ ਯੋਗਦਾਨ ਹੁੰਦੀਆਂ ਹਨ ਸਾਡੇ ਜਿਵੇਂ ਕਿ ਅਸੀਂ ਜਾਣਦੇ ਹਾਂ ਮੋਬਾਈਲ ਨਾਲ ਵੇਖਣ ਨਾਲ ਸਾਨੂੰ ਕਿੰਨੇ ਨੁਕਸਾਨ ਹੁੰਦੇ ਹਨ ਸਾਡੀ ਅੱਖਾਂ ਦੀ ਦ੍ਰਿਸ਼ਟੀ ਘੱਟ ਹੋ ਜਾਂਦੀ ਹੈ ਅਤੇ ਇਹ ਇਹ ਸਭ ਬਹੁਤ ਬੁਰਾ ਹੈ ਇਸ ਲਈ ਸਾਨੂੰ ਲੋਕ ਖੇਡਾਂ ਜ਼ਰੂਰ ਖੇਡਣੀਆਂ ਚਾਹੀਦੀਆਂ ਹਨ ਜੋ ਕਿ ਸਾਡੇ ਲਈ ਬਹੁਤ ਜ਼ਰੂਰੀ ਹਨ ਧੰਨਵਾਦ